ਸਤਿ ਸ਼੍ਰੀ ਅਕਾਲ ਜੀ ਮੈਂ ਬਲਵੰਤ ਰਾਜ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪਹਿਲਾਂ ਸਾਡੇ ਪਿੰਡਾਂ ਵਿੱਚ ਸਰਕਾਰੀ ਬੱਸਾਂ ਲਗਾਈਆਂ ਗਈਆਂ ਸੀ ਕਾਫੀ ਦੇਰ ਤੋਂ ਹੁਣ ਇਹ ਬੱਸਾਂ ਗੋਰਮੈਂਟ ਨੇ ਪਰਮਿਟ ਬੰਦ ਕਰ ਦਿੱਤੇ ਹਨ ਅਤੇ ਅਤੇ ਹੁਣ ਸਾਨੂੰ ਉਹ ਛੋਟੇ ਇਲੈਕਟ੍ਰੋਨਿਕ ਆਟੋ ਜਾਂ ਹੋਰ ਕਿਸੇ ਨੂੰ ਵੱਧ ਪੈਸੇ ਦੇ ਕੇ ਆਪਣੇ ਸਹੀ ਜਗ੍ਹਾ 'ਤੇ ਜਿੱਦਾਂ ਪਠਾਨਕੋਟ ਜਾਣਾ ਜਾਂ ਸੁਜਾਨਪੁਰ ਜਾਣਾ ਹੈ ਲਈ ਆਟੋ ਹੀ ਕਰਕੇ ਜਾਣਾ ਪੈਂਦਾ ਹੈ ਅਤੇ ਜਿੱਦਾਂ ਫਿਰ ਅਸੀਂ ਪਠਾਨਕੋਟ ਤੋਂ ਜਲੰਧਰ ਜਾਂ ਅੰਬਰਸਰ ਜਾਂ ਜੰਮੂ ਲਈ ਬੱਸ ਰਾਹੀਂ ਜਾਣਾ ਹੋਵੇ ਜਾਂ ਟ੍ਰੇਨ ਦੇ ਰਾਹੀਂ ਜਾਣਾ ਜਾਣਾ ਹੋਵੇ ਤਾਂ ਲੋਕਲ ਬੱਸਾਂ ਜਾਂ ਟਰੇਨਾਂ ਵਿੱਚ ਸਾਨੂੰ ਹਮੇਸ਼ਾ ਭੀੜ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਇਲਾਵਾ ਜਿੱਦਾਂ ਅਸੀਂ ਟਰੇਨ ਵਿੱਚ ਜੰਮੂ ਜਿੱਦਾਂ ਕਿ ਡੀ ਐਮ ਯੂ ਨਾਂ ਲੈ ਕੇ ਮੈਂ ਦੱਸ ਦਿੰਦਾ ਹਾਂ ਕਿ ਡੀ ਐਮ ਯੂ ਰਾਹੀਂ ਅਸੀਂ ਲੋਕਲ ਟਰੇਨ ਰਾਹੀਂ ਜੰਮੂ ਜਾਂ ਜਲੰਧਰ ਜਾਂ ਅੰਬਰਸਰ ਜਾਣਾ ਹੈ ਤਾਂ ਉਸ ਵਿੱਚ ਬਾਸ਼ਰੂਮ ਦੀ ਬਹੁਤ ਪ੍ਰੋਬਲਮ ਹੈ ਅਤੇ ਸਟੇਸ਼ਨਾਂ 'ਤੇ ਖਾਣ ਪੀਣ ਦਾ ਤਾਂ ਚਲੋ ਅਸੀਂ ਪਿੰਡਾਂ ਦੇ ਲੋਕਾਂ ਨੇ ਕੀ ਖਾਣਾ ਪੀਣਾ ਹੁੰਦਾ ਹੈ ਲੋਕਲ ਹੀ ਜਾਣਾ ਹੁੰਦਾ ਹੈ ਪਰ ਫਿਰ ਵੀ ਬਾਸ਼ਰੂਮ ਦੀ ਉਹਦੇ 'ਤੇ ਸਾਨੂੰ ਬਹੁਤ ਪ੍ਰਾਬਲਮ ਆਉਂਦੀ ਹੈ ਧੰਨਵਾਦ ਜੀ ਚਲੋ ਜੀ